ਹੈਲੋ ਭਾਅ ਜੀ ਕਿਵੇਂ ਹੋ ਸਰ ਹਾਂਜੀ ਵਧੀਆ ਹੈ ਯਾਰ ਮੈਂ ਨਾ ਇਕ ਚੀਜ਼ ਪੁੱਛਣੀ ਤੁਹਾਡੇ ਤੋਂ ਮੈਂ ਨਾ ਨਵੀਂ ਨਵੀਂ ਨਾ ਖੇਤੀ ਸ਼ੁਰੂ ਕੀਤੀ ਹੈ ਅਤੇ ਨਾ ਮੈਂ ਅਤੇ ਨਾ ਮੇਰੀ ਫ਼ਸਲ ਝਾੜ ਨਹੀਂ ਉੱਗ ਰਿਹਾ ਤਾਂ ਇਹ ਕੋਈ ਤਕਨੀਕ ਨਾਲ ਠੀਕ ਹੋ ਸਕਦੀ ਹੈ ਹਾਂ ਹਰੀ ਕ੍ਰਾਂਤੀ ਆਹ ਇਹਦੇ ਬਾਰੇ ਥੋੜ੍ਹਾ ਦੱਸ ਸਕਦੇ ਤੁਸੀਂ ਅੱਛਾ ਅਤੇ ਥੋੜ੍ਹੀ ਕੈਮੀਕਲ ਫਰਟੀਲਾਈਜ਼ਰ ਬਾਰੇ ਦੱਸ ਸਕਦੇ ਹੋ ਕੈਮੀਕਲ ਫਰਟੀਲਾਈਜ਼ਰ ਅੱਛਾ ਅਤੇ ਇਹ ਹੁੰਦੇ ਕਿਹੜੇ ਕਿਹੜੇ ਟਾਈਪਸ ਦੱਸ ਸਕਦੇ ਥੋੜ੍ਹੇ ਹਾਂਜੀ ਹਾਂਜੀ ਅੱਛਾ ਅੱਛਾ ਓਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਉਹ ਓਕੇ ਅਤੇ ਆਹ ਇਹ ਥੋੜ੍ਹੇ ਦੱਸ ਸਕਦੇ ਐੱਚ ਐੱਚ ਆਈ ਵੀ ਵਗੈਰਾ ਕੁਛ ਅੱਛਾ ਅੱਛਾ ਓਕੇ ਓਕੇ ਚਲੋ ਸਰ ਥੈਂਕ ਯੂ ਸਰ ਬਹੁਤ ਬਹੁਤ ਤੁਹਾਡਾ ਜੇ ਮੈਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਨਾ ਮੈਂ ਤੁਹਾਨੂੰ ਫੋਨ ਕਰ ਲਾਂਗਾ ਹਾਂਜੀ ਹਾਂਜੀ ਓਕੇ ਥੈਂਕ ਯੂ ਸਰ